ਮੈਂ ਤਾਂ ਜੀ ਉਰੇ ਕਦ ਦਾ ਖੜਾ ਹਾਂ ਜੀ ਉਰੇ ਤੁਹਾਡਾ ਡਰਾਈਵਰ ਨਹੀਂ ਆ ਰਿਹਾ ਮੈਨੂੰ ਘੱਟੋ ਘੱਟ ਪੰਦਰ੍ਹਾਂ ਤੋਂ ਵੀਹ ਮਿੰਟ ਹੋਗੇ ਮੇਰਾ ਜ਼ਰੂਰੀ ਕੰਮ ਸੀ ਮੈਂ ਜਾਣਾ ਸੀਗਾ ਅਤੇ ਮੈਂ ਹੁਣ ਹੋਰ ਕੈਬ ਬੁੱਕ ਕਰਨੀ ਹੈ ਤੁਸੀਂ ਆਪਣੇ ਵਾਲੀ ਕੈਬ ਰੱਦ ਕਰਦੋ ਕਿਉਂਕਿ ਤੁਹਾਡਾ ਡਰਾਈਵਰ ਨਹੀਂ ਪਹੁੰਚ ਰਿਹਾ